ਭਾਰਤ ਵਿੱਚ ਸਭ ਨੂੰ ਜ਼ਿਆਦਾ ਚਾਹ ਬਹੁਤ ਪਸੰਦ ਹੈ ਸਵੇਰੇ ਉੱਠਦੇ ਚਾਹੀਦਾ ਦੁਪਹਿਰ ਨੂੰ ਚਾਹੀਦੀ ਹੈ ਰਾਤ ਨੂੰ ਚਾਹੀਦੀ ਹੈ ਸੌਂਦੇ ਟੈਮ ਚਾਹੀਦੀ ਹੈ ਭਾਰਤ ਵਿੱਚ ਭਾਵੇਂ ਜਿੰਨੇ ਮਰਜ਼ੀ ਵਾਰੀ ਚਾਹ ਬਣਾ ਲਓ ਕਿੱਥੇ ਕੰਮ 'ਤੇ ਜਾਣਾ ਹੋਵੇ ਉੱਥੇ ਦੋ ਵਾਰੀ ਚਾਹ ਚਾਹੀਦੀ ਹੈ ਅਤੇ ਤੁਸੀਂ ਆਪਣੇ ਘਰ ਵਿੱਚ ਕਿਸ ਤਰੀਕੇ ਨਾਲ ਆਪਣੇ ਘਰ ਵਿੱਚ ਚਾਹ ਤਰੀਕੇ ਨਾਲ ਬਣਾਉਂਦੇ ਹੋ ਸਾਡੇ ਘਰਾਂ ਵਿੱਚ ਚਾਹ ਬੜੇ ਤਰੀਕੇ ਨਾਲ ਬਣਦੀ ਕੋਈ ਮਸਾਲਾ ਚਾਹ ਪੀਂਦਾ ਹੈ ਕੋਈ ਇਲਾਚੀ ਵਾਲੀ ਪੀਂਦਾ ਕੋਈ ਮੋਟੀ ਇਲਾਇਚੀ ਪਾਉਂਦਾ ਕੋਈ ਸੌਂਫ ਪਾ ਕੇ ਪੀਂਦਾ ਕੋਈ ਜ਼ਿਆਦਾ ਦੁੱਧ ਵਾਲੀ ਚਾਹ ਪੀਂਦਾ ਕੋਈ ਘੱਟ ਦੁੱਧ ਵਾਲੀ ਪੀਂਦਾ ਹੈ ਕੋਈ ਤੇਜ਼ ਪੱਤੀ ਵਾਲੀ ਚਾਹ ਪੀਂਦਾ ਹੈ ਚਾਹ ਬੜੇ ਤਰੀਕੇ ਨਾਲ ਬਣਾਈ ਜਾਂਦੀ ਹੈ ਜੋ ਕਿ ਮੇਨਲੀ ਜੋ ਮੈਨੂੰ ਪਸੰਦ ਹੈ ਮੈਨੂੰ ਜ਼ਿਆਦਾ ਦੁੱਧ ਵਾਲੀ ਚਾਹ ਪਸੰਦ ਹੈ ਕਈ ਮਸਾਲਾ ਘਰ ਬਣਾ ਕੇ ਵਿੱਚ ਇਲਾਇਚੀ ਸੌਂਫ ਵੱਡੀ ਇਲਾਇਚੀ ਕਾਲੀ ਮਿਰਚ ਇਹਨਾਂ ਨੂੰ ਪੀਸ ਕੇ ਰੱਖਦੇ ਹਨ ਅਤੇ ਉਹ ਚਾਹ ਵਿੱਚ ਪਾਂਦੇ ਹਨ ਜਦੋਂ ਵੀ ਚਾਹ ਬਣਾਉਣੀ ਹੋਵੇ ਉਹਦੇ ਨਾਲ ਇੱਕ ਮਸਾਲਾ ਚਾਏ ਦਾ ਫਲੇਵਰ ਆਉਂਦਾ ਹੈ ਅਤੇ ਮੋਸਟਲੀ ਜੋ ਘਰਾਂ ਵਿੱਚ ਨੋਰਮਲੀ ਬਣਦੀ ਆ ਉਹ ਇਲਾਇਚੀ ਪਾ ਕੇ ਬਣਦੀ ਹੈ ਕਿ ਇਲਾਇਚੀ ਦੀ ਫਰੈਗਨੈਂਸ ਖੁਸ਼ਬੂ ਨਾਲ ਚਾਹ ਦਾ ਟੇਸਟ ਹੋਰ ਵਧੀਆ ਹੋ ਜਾਂਦਾ ਚਾਹ ਨੂੰ ਚੰਗੀ ਤਰ੍ਹਾਂ ਕਾੜਿਆਂ ਜਾਂਦਾ ਉਸ ਤੋਂ ਬਾਅਦ ਉਹਨੂੰ ਬਣਾ ਕੇ ਪੀਤਾ ਜਾਂਦਾ ਅਤੇ ਚਾਹ ਹਰ ਇੱਕ ਦਾ ਆਪਣਾ ਸਵਾਦ ਹੁੰਦਾ ਹਰ ਇੱਕ ਦਾ ਆਪਣਾ ਟੇਸਟ ਹੁੰਦਾ ਹੈ ਕਿ ਜੇ ਕਿਸ ਤਰ੍ਹਾਂ ਚਾਹ ਬਣਦੀ ਹੈ ਚਾਹ ਬੜੇ ਤਰੀਕੇ ਨਾਲ ਬਣ ਜਾਂਦੀ ਹੈ ਚਾਹ ਨੂੰ ਕੋਈ ਤੇਜ਼ ਪੱਤੀ ਪਾ ਕੇ ਪੀਂਦਾ ਹੈ ਕੋਈ ਘੱਟ ਮਿੱਠੇ ਵਾਲੀ ਪੀਂਦਾ ਹੈ ਕੋਈ ਮਸਾਲਾ ਚਾਏ ਪੀਂਦਾ ਹੈ ਕੋਈ ਅਦਰਕ ਜਿਸ ਤਰ੍ਹਾਂ ਕਿ ਸਰਦੀਆਂ ਦਾ ਮੌਸਮ ਚੱਲ ਰਿਹਾ ਏ ਅਤੇ ਬਹੁਤ ਹੀ ਜ਼ਿਆਦਾ ਲੋਕ ਅਦਰਕ ਦੀ ਚਾਹ ਪੀਣਾ ਬਹੁਤ ਪਸੰਦ ਕਰਦੇ ਹਨ ਅਤੇ ਅਦਰਕ ਵਿੱਚ ਪਾਣ ਨਾਲ ਸਾਡਾ ਸਰਦੀ ਜੁਕਾਮ ਦਾ ਜਿਹੜਾ ਦਿੱਕਤ ਹੁੰਦੀ ਉਹ ਵੀ ਬੜੀ ਚੰਗੀ ਤਰ੍ਹਾਂ ਠੀਕ ਹੋ ਜਾਂਦੀ ਹੈ ਅਤੇ ਸਰਦੀਆਂ ਦੇ ਮੌਸਮ ਵਿੱਚ ਅਦਰਕ ਵਾਲੀ ਚਾਏ ਬਹੁਤ ਜ਼ਿਆਦਾ ਪੀਤੀ ਜਾਂਦੀ ਹੈ ਅਤੇ ਮੇਨਲੀ ਆਪਾਂ ਇਲਾਇਚੀ ਵਾਲੀ ਪੀਂਦੇ ਹਾਂ